ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਤੋਂ ਵੀਹ ਜੂਨ ਨੂੰ ਮੋਬਾਈਲ ਆਰਡਰ ਕੀਤਾ ਸੀ ਅਤੇ ਉਹ ਮੇਰੇ ਕੋਲ ਸਹੀ ਸਮੇਂ 'ਤੇ ਪਹੁੰਚ ਗਿਆ ਅਤੇ ਜਦੋਂ ਮੈਂ ਉਹਦੀ ਪੈਕਿੰਗ ਖੋਲ੍ਹ ਕੇ ਦੇਖੀ ਤਾਂ ਅੰਦਰੋਂ ਪੂਰਾ ਵਧੀਆ ਸੀਗਾ ਸਾਫ ਸੀਗਾ ਸਾਫ ਨਿਕਲਿਆ ਐਨ ਟੱਚ ਬਿਲਕੁਲ ਵਧੀਆ ਕੰਮ ਕਰਦੀ ਹੈ ਅਤੇ ਕੈਮਰਾ ਵੀ ਵਧੀਆ ਕੰਮ ਕਰਦਾ ਹੈ ਕਾਲਿੰਗ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਵਾਈ ਫਾਈ ਵਧੀਆ ਚੱਲ ਰਿਹਾ ਹੈ ਅਤੇ ਤਸਵੀਰਾਂ ਐਨ ਬਿਲਕੁਲ ਸਾਫ ਆਉਂਦੀਆਂ ਨੇ ਅਤੇ ਇਸ ਦੀ ਮੇਰੇ ਦੋਸਤਾਂ ਯਾਰਾਂ ਮਿੱਤਰਾਂ ਨੇ ਵੀ ਵਧੀਆ ਤਾਰੀਫ ਕੀਤੀ ਅਤੇ ਉਹ ਵੀ ਕਹਿੰਦੇ ਅਸੀਂ ਇਸ ਨਾਲ ਦੇ ਹੋਰ ਆਰਡਰ ਕਰਨੇ ਨੇ ਅਤੇ ਮੈਨੂੰ ਵਧੀਆ ਲੱਗਿਆ ਜੀ